ਤੈਕਨਾਲੋਜੀ ਨੇ ਬਿਰਦਾਂ ਦੀ ਦ੍ਰਿਸ਼ਟੀਹੀਣਾਂ ਦੀ ਬੜੀ ਮਦਦ ਕੀਤੀ ਹੈ ਜੇ ਦੇਖਿਆ ਜਾਵੇ ਤਾਂ ਜਿੱਦਾਂ ਮੇਰੇ ਦਾਦਾ ਜੀ ਹਨ ਜਿਹੜੇ ਜਦੋਂ ਦਾ ਉਹਨਾਂ ਨੂੰ ਨਵਾਂ ਫੋਨ ਮਿਲਿਆ ਉਹਨਾਂ ਲਈ ਧਾਰਮਿਕ ਗ੍ਰੰਥਾਂ ਦੀ ਜਿਹੜੀ ਸੰਥਿਆ ਲੈਣੀ ਉਹ ਬੜੀ ਸੌਖੀ ਹੋ ਗਈ ਹੈ ਪਹਿਲਾਂ ਉਹਨਾਂ ਨੂੰ ਬੜਾ ਸਫਰ ਕਰਕੇ ਸਵੇਰੇ ਸਵੇਰੇ ਤੜਕੇ ਠੰਡ ਵਿੱਚ ਜਾਣਾ ਆਉਣਾ ਪੈਂਦਾ ਸੀ ਹੈ ਨਾ ਪਰ ਹੁਣ ਕੀ ਹੋ ਗਿਆ ਜਦੋਂ ਤੋਂ ਕਰੋਨਾ ਹੋਇਆ ਉਦੋਂ ਤੋਂ ਔਨਲਾਈਨ ਹੀ ਉਹ ਗੂਗਲ ਮੀਟ ਤਾਂ ਜ਼ੂ ਜਾਂ ਜ਼ੂਮ 'ਤੇ ਕਲਾਸ ਲਾ ਲੈਂਦੇ ਨੇ ਅਤੇ ਅਤੇ ਹੋਰ ਯੂਟਿਊਬ 'ਤੇ ਵੀ ਉਹਨਾਂ ਨੂੰ ਜਿਹੜੇ ਕਥਾ ਸੁਣ ਕੇ ਬੜੀ ਮਦਦ ਮਿਲਦੀ ਹੈ ਉਹਨਾਂ ਨੂੰ ਬਾਰ ਬਾਰ ਨਿਗ੍ਹਾ ਲਗਾ ਕੇ ਹੋਰ ਬੜੇ ਡਾਕੂਮੈਂਟਸ ਅਤੇ ਜ਼ਰੂਰੀ ਕਾਗਜ ਪੜ੍ਹਨੇ ਨਹੀਂ ਪੈਂਦੇ ਉਹ ਸਿੱਧਾ ਆਡੀਓ ਬੁੱਕਸ ਰਾਹੀਂ ਜਿਹੜੀਆਂ ਉਹਨਾਂ ਦੀ ਪਸੰਦ ਦੀਆਂ ਕਿਤਾਬਾਂ ਨੇ ਉਹਨਾਂ ਨੂੰ ਸੁਣ ਸਕਦੇ ਨੇ ਅਤੇ ਹੋਰ ਮੇਰੇ ਨਾਲ ਵੀ ਜਦੋਂ ਚਾਹੁਣ ਵੀਡੀਓ ਕਾਲ ਕਰ ਲੈਂਦੇ ਨੇ ਜਿਹਦੇ ਕਰਕੇ ਉਹਨਾਂ ਦਾ ਜੀਅ ਵੀ ਲੱਗਿਆ ਰਹਿੰਦਾ ਅਤੇ ਮੈਂ ਆਸ ਪਾਸ ਵੀ ਦੇਖਦੀ ਹਾਂ ਤਾਂ ਮੇਰੇ ਦਾਦਾ ਜੀ ਦੀ ਉਮਰ ਦੇ ਹੋਰ ਵੀ ਜਿਹੜੇ ਬਿਰਧ ਬਜ਼ੁਰਗ ਮਾਈਆਂ ਅਤੇ ਬਾਬੇ ਹਨ ਇਹ ਸਾਰੇ ਫੋਨ ਦੀ ਮਦਦ ਨਾਲ ਬੜੇ ਜਿਹੜੇ ਜੀਵਨ ਦੇ ਵਿੱਚ ਕੰਮ ਪਹਿਲਾਂ ਔਖੇ ਲੱਗਦੇ ਹੁੰਦੇ ਹੋ ਸਕਦੇ ਸੀ ਉਹ ਸੌਖੇ ਜਾਣ ਕੇ ਕਰ ਲੈਂਦੇ ਹਨ ਜਿਵੇਂ ਗਵਾਂਢੀਆਂ ਦੇ ਜਾਣਾ ਫੋਨ ਕਰਕੇ ਕੋਈ ਸਬਜ਼ੀ ਭਾਜੀ ਮੰਗਾਉਣੀ ਜਾਂ ਫਿਰ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਨੀਆਂ ਅਤੇ ਆਪਣੀਆਂ ਮੀਟਿੰਗਾਂ ਦੇ ਸਮੇਂ ਬੰਨਣੇ ਇਹ ਸਭ ਫੋਨ ਨਾਲ ਸੌਖਾ ਕਰ ਲੈਂਦੇ ਹਨ ਅਤੇ ਦ੍ਰਿਸ਼ਟੀਹੀਣਾਂ ਦੀ ਲਈ ਵੀ ਬੜਾ ਸੌਖਾ ਹੋ ਗਿਆ ਤੈਕਨੋਲਜੀ ਦੇ ਨਾਲ ਜਿਵੇਂ ਬੀ ਮਾਈ ਆਈਜ਼ ਐਪ ਹੋ ਗਿਆ ਔਡੀਓ ਬੁੱਕਸ ਹੋ ਗਈਆਂ ਇਹ ਸਾਰਿਆਂ ਦੀ ਮਦਦ ਨਾਲ ਪੜ੍ਹਾਈ ਵੀ ਕੀਤੀ ਜਾ ਸਕਦੀ ਹੈ ਅਤੇ ਇੱਕ ਦੂਜੇ ਅਤੇ ਇੱਕ ਦੂਜੇ ਦੀ ਸਹਾਇਤਾ ਵੀ ਲਿੱਤੀ ਜਾ ਸਕਦੀ ਹੈ ਜਿਹਦੇ ਕਰਕੇ ਜੀਵਨ ਦੇ ਅੰਦਰ ਆਮ ਕਾਰ ਵਿਹਾਰ ਕਰਨੇ ਉਹਨਾਂ ਲਈ ਬੜੇ ਸੌਖੇ ਹੋ ਗਏ ਹਨ ਹੋਰ ਤਾਂ ਹੋਰ ਜਿੱਦਾਂ ਛੋਟੇ ਹੁੰਦੇ ਮੈਂ ਜਦੋਂ ਜਿਨ੍ਹਾਂ ਤੋਂ ਉਸਤਾਦ ਜੀ ਤੋਂ ਸ਼ਬਦ ਕੀਰਤਨ ਅਤੇ ਹੋਰ ਰਾਗ ਸਿੱਖ ਰਾਗ ਵਿੱਦਿਆ ਲੈਂਦੀ ਸੀ ਉਹ ਉਸਤਾਦ ਜੀ ਨੂੰ ਬਚਪਨ ਤੋਂ ਹੀ ਦਿਸਦਾ ਨਹੀਂ ਸੀ ਨੇਤਰਹੀਣ ਸਨ ਜਿਨਹਾਂ ਨੂੰ ਆਪਾਂ ਪੰਜਾਬੀ ਭਾਸ਼ਾ ਦੇ ਅੰਦਰ ਵਡਿਆ ਕੇ ਸੂਰਮਾ ਸਿੰਘ ਆਖ ਦਿੰਦੇ ਹਨ ਅਤੇ ਲੱਖ ਲੱਖ ਨੇਤਰ ਆਖ ਦਿੰਦੇ ਹਨ ਉਹ ਐਪ ਦੀ ਮਦਦ ਨਾਲ ਹੀ ਜਿਹੜੇ ਸ਼ ਰਾਗ ਹਨ ਉਹਨਾਂ ਨੂੰ ਸਾਨੂੰ ਸਿਖਾ ਦਿਆ ਕਰਦੇ ਸੀ ਅਤੇ ਤਾਨਪੁਰਾ ਪਿੱਛੋਂ ਸੈੱਟ ਕਰਨਾ ਤਾਲਾਂ ਸੈੱਟ ਕਰਨੀਆਂ ਜਿਹਦੇ ਨਾਲ ਉਹਨਾਂ ਦੀ ਬੜੀ ਮਦਦ ਹੋ ਜਾਂਦੀ ਸੀ